ਹਾਂਜੀ ਸ਼ਾਕਵੰਡ ਸ਼ਾਰਕ ਟੈਂਕ ਬਾਰੇ ਮੈਨੂੰ ਪਤਾ ਹੈ ਅਤੇ ਇਹ ਬਹੁਤ ਹੀ ਇੱਕ ਅੱਛਾ ਸ਼ੋਅ ਹੈ ਜੋ ਕਿ ਸਾਡੇ ਹੁਣ ਇੰਡੀਆ ਵਿੱਚ ਵੀ ਅਵੇਲੇਬਲ ਹੈ ਅਤੇ ਇਹਦੇ ਅਸੀਂ ਬਹੁਤ ਸਾਰੇ ਐਪੀਸੋਡ ਦੇਖਦੇ ਹਾਂ ਅਤੇ ਇੱਥੋਂ ਇਹ ਪਤਾ ਲੱਗਦਾ ਹੈ ਕਿ ਜਿਹੜਾ ਵੀ ਇੱਕ ਨਵਾਂ ਆਈਡੀਆ ਨਵਾਂ ਇੱਕ ਜਿਹੜਾ ਵੀ ਕੋਈ ਅਸੀਂ ਲੈ ਕੇ ਆਨੇ ਹਾਂ ਉਹਦੇ ਆਪਾਂ ਨੂੰ ਫੰਡਸ ਪ੍ਰੋਵਾਈਡ ਕਰ ਦਿੰਦੇ ਹਾਂ ਜੇ ਉਹ ਆਈਡੀਆ ਅੱਛਾ ਹੁੰਦਾ ਹੈ ਤਾਂ ਸਾਨੂੰ ਸਾਡੇ ਅਕੋਰਡਿੰਗਲੀ ਜਿੰਨਾ ਅਸੀਂ ਪਰਸੈਂਟੇਜ ਚਾਹੁੰਦੇ ਹਾਂ ਉਨਾ ਪ੍ਰਸੈਂਟ ਸਾਨੂੰ ਮਿਲ ਜਾਂਦਾ ਹੈ ਅਤੇ ਕਈ ਵਾਰ ਜਦੋਂ ਜੇ ਜੱਜਸ ਨੂੰ ਨਹੀਂ ਵੀ ਹੁੰਦਾ ਤਾਂ ਉਹਨਾਂ ਦੀ ਹੈਲਪ ਵੀ ਸਾਨੂੰ ਬਹੁਤ ਸਾਰੀ ਮਿਲ ਜਾਂਦੀ ਹੈ ਅਤੇ ਉਹਨਾਂ ਦੇ ਅਕੋਰਡਿੰਗਲੀ ਫਿਰ ਅਸੀਂ ਅੱਗੇ ਆਪਣਾ ਹੋਰ ਸ਼ੇਅਰ ਵੀ ਆਪਾਂ ਉਹਨਾਂ ਦੇ ਅਕੋਰਡਿੰਗਲੀ ਆਪਾਂ ਹੋਰ ਵੀ ਵਧਵਾ ਸਕਦੇ ਉਹਦੇ ਵਿੱਚ ਅਤੇ ਸੈਕਿੰਡਲੀ ਜਦੋਂ ਇਹ ਸਾਰੇ ਸਾਡੇ ਪ੍ਰੋਡਕਟਸ ਸਾਰੇ ਦੁਨੀਆਂ ਵਿੱਚ ਇੱਕੋ ਤਰ ਵਰ ਟੈਲੀਕਾਸਟ ਹੁੰਦੇ ਆ ਅਤੇ ਉਹਨਾਂ ਦੇ ਨਾਲ ਫਿਰ ਸਾਡੀ ਐਡ ਵੀ ਬਹੁਤ ਅੱਛੀ ਹੋ ਜਾਂਦੀ ਹੈ ਅਤੇ ਸਾਡੀ ਅੱਗੋਂ ਸੇਲਸ ਪ੍ਰੋਸਪੈਕਟਸ ਹੈ ਉਹ ਵੀ ਬਹੁਤ ਅੱਛੇ ਅੱਗੇ ਹੁੰਦੇ ਆ ਅਤੇ ਇਸ ਕਰਕੇ ਮੈਨੂੰ ਤਾਂ ਇਹ ਬਹੁਤ ਹੀ ਮੇਰਾ ਮਨਪਸੰਦ ਦਾ ਪ੍ਰੋਗਰਾਮ ਹੈ ਅਤੇ ਮੈਂ ਇਹਨੂੰ ਜ਼ਰੂਰ ਦੇਖਦੀ ਹਾਂ